ਅਸੀਂ ਸਾਰੇ ਫੈਮਲੀ ਇਕੱਠੇ ਬਹਿ ਕੇ ਖਾਣਾ ਖਾਂਦੇ ਹਾਂ ਜਿਵੇਂ ਕਿ ਮੈਂ ਰੋਜ਼ ਆਪਣੇ ਮੰਮਾ ਨਾਲ ਕਿਚਨ 'ਚ ਹੈਲਪ ਕਰਵਾਉਂਦੀ ਹਾਂ ਜਦੋਂ ਮੰਮਾ ਖਾਣਾ ਬਣਾਉਂਦੇ ਨੇ ਜਿਵੇਂ ਉਹ ਸਬਜ਼ੀ ਤਿਆਰ ਕਰਦੇ ਨੇ ਅਤੇ ਮੈਂ ਫੁਲਕੇ ਲਾ ਲੈਂਦੀ ਇੱਕ ਸਾਈਡ 'ਤੇ ਫੁਲਕੇ ਬਣਾ ਲੈਂਦੀ ਹਾਂ ਅਤੇ ਬਾਅਦ ਵਿੱਚ ਅਸੀਂ ਕਿ ਰਸੋਈ ਵਿੱਚ ਜਗ੍ਹਾ ਬਣਾਈ ਹੋਈ ਹੈ ਅਸੀਂ ਉੱਥੇ ਹੀ ਸਾਈਡ 'ਤੇ ਟੇਬਲ 'ਤੇ ਬੈਠ ਕੇ ਰੋਟੀ ਖਾਂਦੇ ਹਾਂ ਤਾਂ ਕਿ ਇਕੱਠੇ ਬੈਠ ਕੇ ਖਾਣਾ ਖਾਣ ਨਾਲ ਪਿਆਰ ਵੀ ਵੱਧਦਾ ਹੈ ਜੀਆਂ ਵਿੱਚ ਅਤੇ ਇੱਕ ਦੂਜੇ ਨਾਲ ਹਰ ਅ ਆਪਣਾ ਖਾਣਾ ਸਾਂਝਾ ਕਰੀਦਾ ਆ ਅਤੇ ਟਾਈਮ ਬਿਤਾਈਦਾ ਆ ਜੋ ਕਿ ਅੱਜ ਦੇ ਸਮੇਂ ਵਿੱਚ ਬਹੁਤ ਜ਼ਰੂਰੀ ਹੈ ਆਪਣੀ ਫੈਮਲੀ ਨਾਲ ਟਾਈਮ ਸਪੈਂਡ ਕਰਨਾ ਕਿਉਂਕਿ ਸਭ ਕਿਸੇ ਕੋਲ ਇੰਨਾ ਟਾਈਮ ਨਹੀਂ ਹੈਗਾ ਅੱਜ ਕੱਲ੍ਹ ਅਤੇ ਮ ਮੈਂ ਅਤੇ ਮੇਰੇ ਮਦਰ ਦੋਨੋਂ ਇਕੱਠੇ ਰਸੋਈ ਵਿੱਚ ਇਕੱਠੇ ਖਾਣਾ ਬਣਾਉਂਦੇ ਹਾਂ ਜਦੋਂ ਕੋਈ ਗੈਸਟ ਵਗੈਰਾ ਵੀ ਆ ਜਾਂਦਾ ਆ ਤਾਂ ਮੈਂ ਆਪਣੇ ਮਦਰ ਨਾਲ ਹੈਲਪ ਕਰਵਾਉਂਦੀ ਆ ਖਾਣਾ ਬਣਾਉਣ 'ਚ ਅਤੇ ਅਸੀਂ ਇਕੱਠੇ ਸਾਰਾ ਕੁਛ ਤਿਆਰ ਕਰਦੇ ਹਾਂ ਅਤੇ ਅਸੀਂ ਇਕੱਠੇ ਬੈਠ ਕੇ ਖਾਣਾ ਖਾਂਦੇ ਹਾਂ ਅਤੇ ਅਸੀਂ ਇਸੇ ਵਿੱਚ ਬਿਲੀਵ ਕਰਦੇ ਹਾਂ ਕਿ ਸਾਨੂੰ ਅ ਪੁਰਾਣੀ ਪਰੰਪਰਾ ਜਿਵੇਂ ਲੋਕ ਫੋਲੋ ਕਰਦੇ ਸੀ ਤਾਂ ਸਾਨੂੰ ਇਕੱਠੇ ਬੈਠ ਕੇ ਖਾਣਾ ਖਾਣਾ ਚਾਹੀਦਾ ਇਹਦੇ ਨਾਲ ਪਰਿਵਾਰ ਵਿੱਚ ਪਿਆਰ ਵੱਧਦਾ ਆ